ਹੈਕਿੰਗ ਸਮੇਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਵਧੀਆ ਚੰਗੀ ਕੰਪਨੀ ਦੇ ਟਰੈਕਿੰਗ ਬੂਟ ਜੁਰਾਬਾਂ ਵਧੀਆ ਚੰਗੀ ਕੰਪਨੀ ਦਾ ਬੈਗ ਸਲੀਪਿੰਗ ਬੈਗ ਫਰਸਟ ਏਡ ਕਿੱਟ ਕੈਂਪਪਿੰਗ ਗੇਅਰ ਟੈਂਟ ਰਾਤ ਭਰ ਬਾਹਰ ਸੌਣ ਲਈ ਨੈਵੀਗੇਸ਼ਨ ਟੂਲ ਇਹ ਆਦਿ ਚੀਜ਼ਾਂ ਤੁਹਾਡੇ ਕੋਲ ਹੈਕਿੰਗ ਅਤੇ ਟਰੈਕਿੰਗ ਦੌਰਾਨ ਹੋਣੀਆਂ ਚਾਹੀਦੀਆਂ ਹਨ ਹੈਕਿੰਗ ਅਤੇ ਟਰੈਕਿੰਗ ਤੁਹਾਡੇ ਮਨ ਨੂੰ ਖੁਸ਼ੀ ਦਿੰਦਾ ਹੈ ਨਵੀਆਂ ਨਵੀਆਂ ਜਗ੍ਹਾ ਨੂੰ ਦੇਖਣ ਦਾ ਮੌਕਾ ਮਿਲਦਾ ਹੈ ਕੁਦਰਤ ਨਾਲ ਬਹਿਣ ਦਾ ਮੌਕਾ ਮਿਲਦਾ ਹੈ ਉਸ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਅਤੇ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਆਪਣੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਦਿਮਾਗ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਦਾ ਹੈ ਦਿਲ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ ਕੁਝ ਸਾਹ ਦੀਆਂ ਸਮੱਸਿਆ ਅਤੇ ਜ਼ੋਖਮ ਨੂੰ ਘਟਾਉਂਦਾ ਹੈ ਕੁਦਰਤ ਵਿੱਚ ਹੋਣਾ ਤੁਹਾਡੀ ਮਾਨਸਿਕ ਸਿਹਤ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਦਾ ਹੈ ਅੱਜ ਕੱਲ੍ਹ ਜਿਵੇਂ ਡਿਪਰੈਸ਼ਨ ਤਣਾਅ ਚਿੰਤਾ ਚੱਲ ਰਹੀ ਹੈ ਹੈਕਿੰਗ ਅਤੇ ਟਰੈਕਿੰਗ ਇਸ ਤੋਂ ਬਚਾਉਂਦੇ ਹਨ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਡਿਪਰੈਸ਼ਨ ਹੋਣ ਤੋਂ ਹੈਕਿੰਗ ਅਤੇ ਟਰੈਕਿੰਗ ਬਹੁਤ ਸਹਾਇਤਾ ਕਰਦੇ ਹਨ ਕੁਦਰਤ ਨਾਲ ਸਮਾਂ ਬਿਤਾਉਣ ਨਾਲ ਤਣਾਅ ਘੱਟਦਾ ਹੈ ਅਤੇ ਚਿੰਤਾ ਨੂੰ ਚਿੰਤਾ ਤੋਂ ਚਿੰਤਾ ਸ਼ਾਂਤ ਹੁੰਦੀ ਹੈ ਇਸ ਨਾਲ ਮਨੁੱਖੀ ਦਿਮਾਗ ਵਧੀਆ ਕੰਮ ਕਰਨ ਵਿੱਚ ਸਹਾਇਕ ਹੁੰਦਾ ਹੈ ਧੰਨਵਾਦ